ਲੋਕ ਵਿਆਹ 'ਤੇ ਕਈ ਤਰ੍ਹਾਂ ਦੇ ਤੋਹਫੇ ਦਿੰਦੇ ਹਨ ਅੱਜ ਕੱਲ੍ਹ ਲੋਕ ਵਿਆਹ 'ਤੇ ਨਵੇਂ ਨਵੇਂ ਤੋਹਫੇ ਨਵੀਂ ਨਵੀਂ ਚੀਜ਼ਾਂ ਨਵੇਂ ਨਵੇਂ ਜੋ ਉਹਨਾਂ ਦੇ ਕੰਮ ਆਉਣ ਉਹੋ ਜਿਹੀਆਂ ਚੀਜ਼ਾਂ ਦਿੰਦੇ ਹਨ ਜਿਵੇਂ ਕਿ ਬਿਸਤਰੇ ਕੱਪੜੇ ਸ਼ਗਨ ਉਹ ਜਵੈਲਰੀ ਅ ਗਹਿਣੇ ਹੋਰ ਵੀ ਕਈ ਤਰ੍ਹਾਂ ਦੇ ਗਿਫਟਸ ਦਿੰਦੇ ਆ ਜੋ ਕਿ ਚਦ ਚਾਦਰ ਇੱਦਾਂ ਦੀ ਚੀਜ਼ਾਂ ਦਿੰਦੇ ਹਨ ਜੋ ਕਿ ਉਹਨਾਂ ਦੇ ਕੰਮ ਆਵੇ ਅੱਗੇ ਜਾ ਕੇ ਉਹਨਾਂ ਦੇ ਅ ਵਿਆਹ ਤੋਂ ਬਾਅਦ ਉਹਨਾਂ ਨੂੰ ਉਹ ਚੀਜ਼ਾਂ ਵਰਤਣ ਉਹ ਉਹਨਾਂ ਨੂੰ ਵਧੀ ਮਤਲਬ ਵਧੀਆ ਦਿੰਦੇ ਆ ਤਾਂ ਕਰਕੇ ਤੇ ਅੱਜ ਕੱਲ੍ਹ ਲੋਕ ਮਾਪੇ ਆਪਣੀ ਧੀਆਂ ਨੂੰ ਦਾਜ ਵੀ ਦਿੰਦੇ ਹਨ ਅਤੇ ਵਿ ਦਾਜ ਤੋਂ ਬਿਨਾਂ ਤਾਂ ਅੱਜ ਕੱਲ੍ਹ ਲੋਕ ਵਿਆਹ ਹੀ ਨਹੀਂ ਕਰਦੇ ਦਾਜ ਤਾਂ ਇੰਨਾ ਮੰਨਿਆ ਜਾਂਦਾ ਕਿ ਦਾਜ ਅ ਮੁੰਡੇ ਵਾਲੇ ਦਾਜ ਲੈਂਦੇ ਆ ਅਤੇ ਕੁੜੀਆਂ ਵਾਲੇ ਮੁੰਡੇ ਵਾਲਿਆਂ ਨੂੰ ਦਾਜ ਦਿੰਦੇ ਹਨ ਦਾਜ ਵਿੱਚ ਬੜੀ ਚੀਜ਼ਾਂ ਹੁੰਦੀਆਂ ਜਿੱਦਾਂ ਸੋਫੇ ਬੈਡ ਅਲਮੀਰਾ ਫਰਨੀਚਰ ਭਾਂਡੇ ਕੱਪੜੇ ਗਹਿਣੇ ਸਭ ਕੁਛ ਪੈਸੇ ਸਭ ਕੁਛ ਇੰਨਾ ਦਾਜ ਦਿੰਦੇ ਹਨ ਤੇ ਮੁੰਡੇ ਵਾਲਿਆਂ ਨੂੰ ਤੇ ਆਪਣੀ ਧੀਆਂ ਵੀ ਦਿੰਦੇ ਆ ਨਾਲ ਅਤੇ ਨਾਲ ਦਾਜ ਵੀ ਉਹਨਾਂ ਨੂੰ ਦਿੰਦੇ ਹਨ ਅਤੇ ਦਾਜ ਲੈ ਕੇ ਉਹ ਦਾਜ ਦਾਜ ਲੈ ਤੇ ਉਹ ਬਹੁਤ ਖੁਸ਼ ਹੋ ਜਾਂਦੇ ਹਨ ਮਾਂ ਪਿਓ ਆਪਣੀ ਧੀਆਂ ਦੇ ਨਾਮ ਨਾਲ ਦਾਜ ਵੀ ਦਿੰਦੇ ਆ ਅਤੇ ਦਾਜ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿੰਨਾ ਮਹਿੰਗਾ ਆਉਂਦਾ ਵਾ ਮਾਪੇ ਕਿੰਨਾ ਹੀ ਪੈਸਾ ਲਾਉਂਦੇ ਆਪਣੇ ਧੀ ਦੇ ਵਿਆਹ 'ਤੇ ਅਤੇ ਮੁੰਡੇ ਵਾਲੇ ਵੀ ਬ ਬਹੁਤ ਵੈਸੇ ਅੱਜ ਕੱਲ੍ਹ ਦਾਜ ਤਾਂ ਪਾਪ ਹੈ ਲੈਣਾ ਪਰ ਫਿਰ ਵੀ ਮੁੰਡੇ ਵਾਲੇ ਹਾਲੇ ਤੱਕ ਦਾਜ ਲੈਂਦੇ ਆ ਕੁੜੀ ਵਾਲਿਆਂ ਕੋਲੋਂ ਧੰਨਵਾਦ